ਟੈਕਨੋਲੋਜੀ ਨੇ ਵੱਖ ਵੱਖ ਭਾਈਚਾਰਿਆਂ ਦੀ ਏਕਤਾ ਲਿਆਉਣ ਵਿੱਚ ਬਹੁਤ ਕੰਮ ਕੀਤਾ ਹੈ ਇਸ ਨਾਲ ਬਹੁਤ ਧਰਮਾਂ ਦੇ ਲੋਕ ਅੱਗੇ ਵਧ ਕੇ ਆਏ ਹਨ ਅਤੇ ਇੱਕ ਦੂਜੇ ਨੂੰ ਕੰਮ ਵਿੱਚ ਸਹਾਰਾ ਦੇ ਰਹੇ ਹਨ ਟੈਕਨੋਲੋਜੀ ਸਾਡੀ ਜੀਵਨ ਸ਼ੈਲੀ ਦਾ ਇਕ ਮਹੱਤਵਪੂਰਨ ਪਾਰਟ ਬਣ ਚੁੱਕਾ ਹੈ ਪਰ ਇਸ ਦਾ ਕਈ ਲੋਕ ਗਲਤ ਇਸਤੇਮਾਲ ਵੀ ਕਰਦੇ ਹਨ ਜੋ ਕਿ ਕੁਝ ਤਰ੍ਹਾਂ ਦੇ ਭਾਈਚਾਰੇ ਨੂੰ ਖ਼ਤਮ ਕਰਨ ਦੀ ਅਤੇ ਉਸ ਬਾਰੇ ਨਫ਼ਰਤ ਵਾਲੀ ਸਮੱਗਰੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਨਾ ਹੀ ਟੈਕਨੋਲੋਜੀ ਨੂੰ ਅੱਗੇ ਵਧਾਉਣ ਵਿੱਚ ਵਧਾਉਣ ਦਾ ਸਹੀ ਤਰੀਕਾ ਹੈ ਇਸ ਦੇ ਨਾਲ ਹੀ ਅਸੀਂ ਦੂਰ ਬੈਠਿਆਂ ਹੀ ਜਾਂ ਫਿਰ ਔਨਲਾਈਨ ਮੀਟਿੰਗਸ ਜਾਂ ਟਰਾਂਸਲੇਸ਼ਨ ਨਾਲ ਅਸੀਂ ਕਿ ਵੱਖ ਵੱਖ ਤਰ੍ਹਾਂ ਦੇ ਲੋਕਾਂ ਨਾਲ ਮਿਲ ਜੁਲ ਸਕਦੇ ਹਾਂ ਇਸ ਨੂੰ ਅਸੀਂ ਵਰਚੁਅਲ ਮੀਟ ਦਾ ਨਾਮ ਵੀ ਦੇ ਸਕਦੇ ਹਾਂ ਪਰ ਜਦੋਂ ਇਹੀ ਕੰਮ ਸੋਸ਼ਲ ਮੀਡੀਆ 'ਤੇ ਗਲਤ ਤਰੀਕੇ ਨਾਲ ਫੈਲਾਇਆ ਜਾਂਦਾ ਹੈ ਜਾਂ ਕਿਸੇ ਨੂੰ ਨੀਚਾ ਦਿਖਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਹ ਟੈਕਨੋਲੋਜੀ ਦਾ ਗਲਤ ਇਸਤੇਮਾਲ ਹੈ ਜਿੱਦਾਂ ਕਿ ਕੋਈ ਛੋਟੀ ਜਾਤੀ ਦੇ ਲੋਕਾਂ ਨੂੰ ਤੰਗ ਕਰਨਾ ਜਾਂ ਫਿਰ ਉਹਨਾਂ ਦੇ ਬਾਰੇ ਮਜ਼ਾਕ ਉਡਾ ਕੇ ਉਸ ਨੂੰ ਇੰਟਰਨੈਟ 'ਤੇ ਪਾਉਣਾ ਇੱਕ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਅਤੇ ਇਹ ਧੱਕੇਸ਼ਾਹੀ ਵੀ ਬਿਲਕੁਲ ਗਲਤ ਹੈ ਮੈਂ ਇਸ ਦੇ ਖਿਲਾਫ਼ ਹਾਂ